ਹਾਂਜੀ ਮੈਂ ਤੁਹਾਡੇ ਤੋਂ ਕੁਛ ਸਮਾਂ ਪਹਿਲਾਂ ਇੱਕ ਪ੍ਰੋਡਕਟ ਔਡਰ ਕੀਤਾ ਸੀ ਉਹ ਪ੍ਰੋਡਕਟ ਕੁੜਤੀ ਸੀ ਅਤੇ ਜਿੱਦਾਂ ਦਾ ਮੈਂ ਔਡਰ ਕੀਤਾ ਸੀ ਇਹ ਪ੍ਰੋਡਕਟ ਮੈਨੂੰ ਉਵੇਂ ਦਾ ਨਹੀਂ ਪ੍ਰਾਪਤ ਹੋਇਆ ਅਤੇ ਮੈਨੂੰ ਇਹ ਦੇਖ ਕੇ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਅਤੇ ਜੋ ਕਲਰ ਮੈਂ ਸਿਲੈਕਟ ਕਰ ਕੇ ਭੇਜਿਆ ਸੀਗਾ ਉਹ ਤੋਂ ਮੈਨੂੰ ਬਿਲਕੁਲ ਅਲੱਗ ਕਲਰ ਭੇਜ ਦਿੱਤਾ ਗਿਆ ਅਤੇ ਜਿਹੜੇ ਡਿਜ਼ਾਈਨਜ਼ ਮੈਂ ਕੁੜਤੀ 'ਤੇ ਦੇਖੇ ਸੀ ਬਿਲਕੁਲ ਵੀ ਉਵੇਂ ਦੇ ਡਿਜ਼ਾਈਨ ਨਹੀਂ ਸੀ ਕੁੜਤੀ 'ਤੇ ਹਾਂ ਉਹਦੇ ਨਾਲ਼ ਮਿਲਦੇ ਜੁਲਦੇ ਸੀ ਬਟ ਜੋ ਮੈਂ ਐਕਜੈਕਟ ਔਡਰ ਕੀਤਾ ਸੀ ਮੈਨੂੰ ਉਹ ਔਡਰ ਨਹੀਂ ਪ੍ਰਾਪਤ ਹੋਇਆ ਅਤੇ ਮੈਂ ਤੁਹਾਡੇ ਤੋਂ ਇਸ ਗੱਲ ਤੋਂ ਬਹੁਤ ਜ਼ਿਆਦਾ ਨਿਰਾਸ਼ ਹਾਂ ਅਤੇ ਇਸ ਦਾ ਜੋ ਸਟੱਫ ਹੈ ਕੁੜਤੀ ਦਾ ਉਹ ਵੀ ਕੋਈ ਖਾਸ ਵਧੀਆ ਨਹੀਂ ਆ ਅਤੇ ਕਲਰ ਵੀ ਬਹੁਤ ਜਲਦੀ ਫੇਟ ਹੋ ਗਿਆ ਹੈ ਅਤੇ ਇਹ ਦੇਖਣ ਦੇ ਵਿੱਚ ਵੀ ਕੋਈ ਜ਼ਿਆਦਾ ਖਾਸ ਸੋਹਣੀ ਨਹੀਂ ਹੈ